ਹਾਂਜੀ ਮੈਂ ਆਪਣੇ ਰਾਜ ਤੋਂ ਬਾਹਰ ਸਾਊਥ ਇੰਡੀਆ ਮਹਾਰਾਸ਼ਟਰ ਵਿੱਚ ਯਾਤਰਾ ਕੀਤੀ ਹੈ ਲਗਾਤਾਰ ਪੰਜ ਸਾਲ ਅੱਗੇ ਮੈਂ ਹੈਦਰਾਬਾਦ ਸਾਈਡ ਗਈ ਹਾਂ ਇਹਦੇ ਵਿੱਚ ਮੇਰੀ ਯਾਤਰਾ ਦਾ ਉਦੇਸ਼ ਮੇਰਾ ਐਜੂਕੇਸ਼ਨਲ ਟੂਰ ਸੀ ਜੀ